ਪੰਦਰਾਂ ਸਤੰਬਰ ਦੋ ਹਜ਼ਾਰ ਤੇਰ੍ਹਾਂ ਇੱਕ ਜਨਵਰੀ ਦੋ ਹਜ਼ਾਰ ਵੀਹ ਇਕੱਤੀ ਅਕਤੂਬਰ ਦੋ ਹਜ਼ਾਰ ਬਾਰ੍ਹਾਂ ਗਿਆਰ੍ਹਾਂ ਨਵੰਬਰ ਉੱਨੀ ਸੌ ਪੈਂਹਠ ਬਾਈ ਅਗਸਤ ਉੱਨੀ ਸੌ ਨੜਿਨਵੇਂ